ਹਾਂਜੀ ਕਾਫੀ ਲੋਕ ਵਾਤਾਵਰਨ ਵਿੱਚ ਦਿਲਚਸਪੀ ਰੱਖਦੇ ਹਨ ਵਾਤਾਵਰਨ ਵਿੱਚ ਜਿਵੇਂ ਕਿ ਵਾਤਾਵਰਨ ਖੁਦ ਆ ਜਾਂਦਾ ਹੈ ਵਾਤਾਵਰਨ ਵਿੱਚ ਜਨ ਜਾਨਵਰ ਪੰਛੀ ਵੀ ਆ ਜਾਂਦੇ ਹਨ ਕਈ ਲੋਕਾਂ ਦਾ ਵਾਤਾਵਰਨ ਵਿੱਚ ਪੰਛੀਆਂ ਵੱਲ ਕਾਫੀ ਰੁਝਾਨ ਹੁੰਦਾ ਹੈ ਅਸੀਂ ਉਹਨਾਂ ਨੂੰ ਸੁਝਾਅ ਦੇਣੇ ਚਾਹੁੰਦੇ ਹਾਂ ਜੋ ਲੋਕ ਪੰਛੀ ਦੇਖਣ ਵਾਲਿਆਂ ਲਈ ਸੁਝਾਅ ਹਨ ਜੋ ਲੋਕ ਵਿਗਿਆਨ ਜਾਂ ਖੋਜ ਪ੍ਰੋਜੈਕਟਾਂ ਵਿੱਚ ਵਧੇਰੇ ਸ਼ਾਮਿਲ ਹੋਣਾ ਚਾਹੁੰਦੇ ਹਨ ਉਹਨਾਂ ਲਈ ਕੁਛ ਸੁਝਾਅ ਇਹ ਹਨ ਪਹਿਲਾ ਤਾਂ ਉਹ ਫਾਰਮਾਂ ਵਿੱਚ ਔਨਲਾਈਨ ਜਿਹੜੇ ਫਾਰਮ ਹੁੰਦੇ ਆ ਉਹਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰੋ ਸਰਕਾਰ ਵੱਲੋਂ ਕਾਫੀ ਔਨਲਾਈਨ ਫਾਰਮ ਨਿਕਲਦੇ ਹਨ ਆਨਲਾਈਨ ਫਾਰਮ ਨਿਕਲਦੇ ਹਨ ਉਹਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰੋ ਉੱਥੇ ਸਾਨੂੰ ਜਾ ਕੇ ਪੰਛੀਆਂ ਦੀ ਜਾਤ ਕਿਹੜੀ ਹੈ ਪੰਛੀਆਂ ਦਾ ਰੰਗ ਕਿਹੜਾ ਪੰਛੀਆਂ ਦਾ ਜ਼ਿੰ ਨਿੱਜੀ ਜ਼ਿੰਦਗੀ ਕਿੱਦਾਂ ਜਿਊਂਦੇ ਹਨ ਪੰਛੀਆਂ ਦਾ ਰਹਿਣ ਸਹਿਣ ਕਿਸ ਤਰੀਕੇ ਦਾ ਹੁੰਦਾ ਹੈ ਉਹਨਾਂ ਦੀ ਸਾਰੀ ਜ਼ਿੰਦਗੀ ਬਾਰੇ ਉਹਨਾਂ ਦੇ ਸਾਰੇ ਵਾਤਾਵਰਨ ਬਾਰੇ ਪਤਾ ਲੱਗਦਾ ਹੈ ਸਾਨੂੰ ਉਹਨਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਜੇ ਅਸੀਂ ਪ੍ਰੋਜੈਕਟਾਂ ਵਿੱਚ ਜਾਣਾ ਚਾਹੁੰਦੇ ਹਨ ਦੂਸਰੀ ਗੱਲ ਹੈ ਸਾਨੂੰ ਖੋਜ ਪ੍ਰੋਜੈਕਟਾਂ ਵਿੱਚ ਵਧੇਰੇ ਸ਼ਾਮਿਲ ਹੋਣਾ ਚਾਹੀਦਾ ਹੈ ਸਾਨੂੰ ਲੋਕਾਂ ਨਾਲ ਮਿਲ ਕੇ ਇਸ 'ਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਸਾਨੂੰ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ ਜਿਹੜੇ ਲੋਕ ਹੋਰ ਇਹਨਾਂ ਪ੍ਰੋਜੈਕਟਾਂ ਵਿੱਚ ਜੁੜੇ ਹੋਏ ਹਨ ਉਹਨਾਂ ਦੀ ਰਾਏ ਲੈਣ ਨਾਲ ਆਪਣੀ ਰਾਏ ਸਾਂਝੀ ਕਰਨ ਨਾਲ ਸਾਨੂੰ ਜਾਣਕਾਰੀ ਦਾ ਆਦਾਨ ਪ੍ਰਦਾਨ ਹੁੰਦਾ ਹੈ ਤੀਸਰੀ ਗੱਲ ਸਾਨੂੰ ਆਪਣੇ ਆਸ ਪਾਸ ਵਾਤਾਵਰਨ ਵਿੱਚ ਜਿਹੜੇ ਪੰਛੀ ਰਹਿ ਰਹੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਹੈ ਉਹਨਾਂ ਦਾ ਰਹਿਣ ਸਹਿਣ ਕਿਸ ਤਰੀਕੇ ਦਾ ਹੈ ਉਹ ਖਾਂਦੇ ਕੀ ਹਨ ਉਹ ਰਹਿੰਦੇ ਕਿੱਦਾਂ ਹਨ ਉਹ ਸਵੇਰੇ ਕੀ ਕਰਦੇ ਹਨ ਉਹਨਾਂ ਨਾਲ ਪਿਆਰ ਪਾਉਣਾ ਚਾਹੀਦਾ ਹੈ ਪੰਛੀਆਂ ਨਾਲ ਪਿਆਰ ਪਾਉਣ ਨਾਲ ਅਸੀਂ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਜ਼ਿਆਦਾ ਰੁਝਾਨ ਪਾ ਸਕਦੇ ਹਾਂ ਚੌਥਾ ਸਾਨੂੰ ਜਿਹੜੇ ਸਰਕਾਰ ਵੱਲੋਂ ਚਲਾਏ ਗਏ ਕਾਫੀ ਰੁਝਾਨ ਹੁੰਦੇ ਹਨ ਉਹਨਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ ਪੰਜਵਾਂ ਅਤੇ ਆਖਰੀ ਪੁਆਇੰਟ ਹੈ ਅੱਜ ਕੱਲ੍ਹ ਇਲੋ ਵਲੋਗਿੰਗ ਬੜੀ ਚੱਲਦੀ ਹੈ ਸਾਨੂੰ ਪੰਜਾਬੀ ਵੀਲੋਗਰ ਜਿਹੜੇ ਕਿ ਕਾਫੀ ਜੰਗਲਾਂ 'ਚ ਘੁੰਮਦੇ ਹਨ ਅਤੇ ਪੰਛੀਆਂ ਦੀ ਫੋਟੋਗ੍ਰਾਫੀ ਕਰਕੇ ਪਾਉਂਦੇ ਹਨ ਵੀਡੀਓ ਪਾਉਂਦੇ ਹਨ ਸਾਨੂੰ ਉਹਨਾਂ ਦੀ ਫੋਟੋਗ੍ਰਾਫੀ ਦੇਖਣੀ ਚਾਹੀਦੀ ਹੈ ਵਿਲੋਗਿੰਗ ਦੇਖਣੀ ਚਾਹੀਦੀ ਹੈ ਸਾਨੂੰ ਉੱਥੋਂ ਵੀ ਕਾਫੀ ਜਾਣਕਾਰੀ ਮਿਲ ਸਕਦੀ ਹੈ